ਯੋਗਾ ਇੱਕ ਅਜਿਹਾ ਅਭਿਆਸ ਹੈ ਜਿਹੜੀ ਮਨ ਅਤੇ ਤਨ ਦੋਨਾਂ ਨੂੰ ਸਹੀ ਕਰ ਸਕਦੀ ਹੈ ਯੋਗਾ ਦਾ ਮਤਲਬ ਹੀ ਆਤਮਾ ਦਾ ਪਰਮਾਤਮਾ ਨਾਲ ਮੇਲ ਹੁੰਦਾ ਹੈ ਯੋਗਾ ਦਾ ਅਭਿਆਸ ਵਿਅਕਤੀਗਤ ਵਿਕਾਸ ਅਤੇ ਸਵੈ ਖੋਜ ਵਿੱਚ ਸਹੂਲਤ ਪ੍ਰਦਾਨ ਕਰਦਾ ਹੈ ਸਾਨੂੰ ਸਾਡੇ ਬਾਰੇ ਹੋਰ ਜਾਣਨ ਨੂੰ ਮਿਲਦਾ ਹੈ